ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਕਲੀਨਿਕ ਪਰ ਐਂ ਜੀ ਅੱਛਾ ਜੀ ਜਿਹੜੀ ਦਵਾਈ ਲੈ ਕੇ ਗਏ ਤੇ ਤੁਸੀਂ ਬੱਚੇ ਨੂੰ ਹਾਂਜੀ ਹਾਂਜੀ ਠੀਕ ਨਹੀਂ ਹੈਗੇ ਜੀ ਬੱਚੇ ਹਾਲੇ ਅੱਛਾ ਜੀ ਸਰ ਤੁਸੀਂ ਤੁਸੀਂ ਐਂ ਕਰਿਓ ਫਿਰ ਬੱਚੇ ਨੂੰ ਦੁਬਾਰਾ ਲੈ ਕੇ ਆਇਓ ਜੀ ਕਲੀਨਿਕ 'ਤੇ ਹਾਂ ਸਵਾਰ ਕੇ ਟੈਸਟ ਕਰ ਅੱਛਾ ਜੀ ਨਾਲੇ ਆਪਾਂ ਸੈਲਾਂ ਦਾ ਟੈਸਟ ਕਰ ਲਾਂਗੇ ਅਤੇ ਨਾਲੇ ਦਵਾਈ ਬਦਲ ਕੇ ਦੇ ਦਾਂਗੇ ਉਹਨੂੰ ਹਾਂਜੀ ਹਾਂਜੀ ਫਿਰ ਤਾਂ ਦਵਾਈ ਵਧੀਆ ਦੇ ਦਾਂਗੇ ਨਾ ਫਿਰ ਸੈਟ ਹੋਜੂਗਾ ਅੱਛਾ ਚਲੋ ਕੋਈ ਨਾ ਉਹਨੂੰ ਆਪਾਂ ਕੋਈ ਗੂਲੂਕੋਸ ਠੰਡਾ ਆਪਣਾ ਦੇ ਦਾਂਗੇ ਹਾਜ਼ਮੇ ਵਾਲੀ ਕੋਈ ਦਵਾਈ ਅਤੇ ਨਾਲੇ ਟੈਸਟ ਕਰ ਲਾਂਗੇ ਸੈਲਾਂ ਦੇ ਬੁਖਾਰ ਦੀ ਵਧੀਆ ਦਵਾਈ ਬਦਲ ਕੇ ਦੇ ਦਾਂਗੇ ਆਪਾਂ ਹਾਂ ਹਾਂ ਰੋਟੀ ਥੋੜ੍ਹੀ ਜਿਹੀ ਹਲਕਾ ਖਾਣਾ ਦੇ ਸਕਦੇ ਹੋ ਤੁਸੀਂ ਜ਼ਿਆਦਾ ਸਖਤ ਖਾਣਾ ਨਹੀਂ ਦੇ ਸਕਦੇ ਹਲਕਾ ਜਾ ਦੇ ਦਿੰਦੇ ਚਾਹ ਥੋੜ੍ਹੀ ਜਿਹੀ ਘੱਟ ਦਿਓ ਜ਼ਿਆਦਾ ਤੌਰ 'ਤੇ ਦੁੱਧ 'ਚ ਪੱਤੀ ਉਬਾਲ ਕੇ ਦੇ ਸਕਦੇ ਹੋ ਥੋੜ੍ਹੀ ਬਹੁਤੀ ਅਤੇ ਹਾਂ ਅਤੇ ਲੱਸੀ ਦਿਉ ਇੱਕ ਤਾਂ ਜੂਸ ਜਾਸ ਅੱਛਾ ਹਾਂ ਮਸੰਮੀ ਦਾ ਜੂਸ ਥੋੜ੍ਹਾ ਜਿਹਾ ਵੱਧ ਦਿਓ ਦਵਾਈ ਆਪਾਂ ਤੁਸੀਂ ਕਲੀਨਿਕ 'ਤੇ ਆਇਓ ਫਿਰ ਮੈਂ ਤੁਹਾਨੂੰ ਦਵਾਈ ਦੇ ਦੂੰਗਾ ਇੰਨੇ ਤੁਸੀਂ ਹਲੇ ਇਹਨੂੰ ਜੂਸ ਜਾਸ ਪਲਾਓ ਅਤੇ ਮੇਰੇ ਕੋਲ ਵੀ ਪੇਸ਼ੈਂਟ ਜ਼ਿਆਦਾ ਨੇ ਥੋੜ੍ਹੇ ਜੇ ਇੱਕ ਫਿਰ ਬੱਚੇ ਨੂੰ ਆਪਾਂ ਨੇ ਸੇਫਟੀ ਚੈੱਕ ਕਰਨਾ ਹੁੰਦਾ ਬਾਹਲਾ ਟਾਈਮ ਬਿਠਾ ਵੀ ਨਹੀਂ ਸਕਦੇ ਫਿਰ ਸਰ ਬੁਖ਼ਾਰ ਅੱਛਾ ਬੁਖਾਰ ਤਾਂ ਫਿਰ ਵੀ ਖ਼ਾਸਾ ਏ ਬੁਖ਼ਾਰ ਤਾਂ ਹਾਂ ਹਾਂ ਸਰ ਕਮਜ਼ੋਰੀ ਆ ਗਈ ਨਾ ਕਾਂਬਾ ਤਾ ਤਾਂ ਚੜ੍ਹਦਾ ਕਮਜ਼ੋਰੀ ਪੈ ਗਈ ਜਿਹੜੇ ਸੈਲ ਘੱਟ ਜਾਂਦੇ ਨੇ ਨਾ ਇਹ ਕਮਜ਼ੋਰੀ ਪਾ ਦਿੰਦੇ ਨੇ ਕੋਈ ਘਬਰਾਉਣ ਵਾਲੀ ਲੋੜ ਤਾਂ ਹੈ ਨਹੀਂ ਚਲੋ ਤੁਸੀਂ ਐਂ ਕਰਿਓ ਮੇਰੇ ਕਲੀਨਿਕ 'ਤੇ ਬੱਚੇ ਨੂੰ ਲਿਆਓ ਅਤੇ ਆਪਾਂ ਦਵਾਈ ਵਧੀਆ ਦੇ ਦਾਂਗੇ ਉਹਨਾਂ ਨੂੰ ਆ ਜਿਓ ਚੰਗਾ